ਪੰਜਾਬ ਵਿੱਚ ਨਿਊਜ਼ ਮੀਡੀਆ ਬਹੁਤ ਹੀ ਜ਼ਿਆਦਾ ਮਾਇਨੇ ਰੱਖਦੀ ਹੈ ਕਿਉਂਕਿ ਪਨ ਇੱਕ ਨਿਊਜ਼ ਚੈਨਲ ਹੀ ਹੈ ਜੋ ਕਿ ਸਾਨੂੰ ਸਾਰੇ ਤਰ੍ਹਾਂ ਦੀ ਗਰਾਊਂਡ ਰਿਪੋਰਟਿੰਗ ਅਤੇ ਸਮਾਜ 'ਚ ਕੀ ਕੀ ਹੋ ਰਿਹਾ ਹੈ ਅਤੇ ਸਮਾਜ ਕੀ ਕੀ ਅਸੀਂ ਫਰਕ ਪਾ ਸਕਦੇ ਹਾਂ ਉਸ ਦੇ ਬਾਰੇ ਸਾਨੂੰ ਪੂਰਾ ਮਦਦ ਕਰਦੀ ਹੈ ਆਹ ਸਾਡੇ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਦੇ ਨਾਲ ਵੀ ਬਹੁਤ ਹੀ ਸੰਬੰਧਿਤ ਹੈ ਕਈ ਵਾਰ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅਤੇ ਸਰਕਾਰਾਂ 'ਚੋਂ ਜੋ ਵੀ ਚੀਜ਼ ਸਾਨੂੰ ਮਿਲਦੀਆਂ ਹਨ ਅਤੇ ਉਹ ਅਗਰ ਸਰਕਾਰਾਂ ਨਾਲ ਵੀ ਸਾਨੂੰ ਸੁਚਾਰੂ ਢੰਗ ਨਾਲ ਉਹ ਚੀਜ਼ਾਂ ਨੂੰ ਲੈ ਕੇ ਦਿੰਦੇ ਹਨ ਅਤੇ ਅਤੇ ਕੋਈ ਵੀ ਗੱਲਾਂ ਨੂੰ ਗਰਾਊਂਡ ਰੈਡਿਟ 'ਤੇ ਜਾ ਕੇ ਉਸ ਨੂੰ ਕਵਰ ਕਰਦੇ ਨੇ ਇਹ ਸਾਨੂੰ ਸਾਡੇ ਅਧਿਕਾਰਾਂ ਦੇ ਜਿਹੜੇ ਵੀ ਸਾਡੇ ਅਧਿਕਾਰ ਸਮਾਜਿਕ ਸਿੱਖਿਆ ਸਮਾਜਿਕ ਸਵਾਸਥ ਸਮਾਜਿਕ ਮਕਾਨ ਅਤੇ ਹੋਰ ਵੀ ਸਾਡੀ ਬਹੁਤ ਸਾਰੀ ਜ਼ਰੂਰਤਾਂ ਨੂੰ ਸਾਨੂੰ ਸਰਕਾਰਾਂ ਦੀ ਨਵੀਂ ਨਵੀਂ ਸਕੀਮਾਂ ਜੋ ਲਾਂਚ ਹੁੰਦੀਆਂ ਹਨ ਅਗਰ ਸਰਕਾਰ ਕਿਸੇ ਪਾਸੇ ਨਹੀਂ ਪੂਰੀ ਕਰ ਪਾਉਂਦੀ ਉਹਦੇ ਬਾਰੇ ਵੀ ਉਹਨਾਂ ਤੋਂ ਗੱਲਾਂ ਬਾਤਾਂ ਕਰਕੇ ਸਾਨੂੰ ਉਹਦੇ ਬਾਰੇ ਬਿਓਰਾ ਸਹੀ ਪ੍ਰਾਪਤ ਕਰਾਉਂਦੇ ਹਨ